ਸਤਿ ਸ਼੍ਰੀ ਅਕਾਲ ਜੀ ਪੇਂਟਿੰਗ ਦਾ ਮੈਨੂੰ ਸ਼ੁਰੂ ਤੋਂ ਹੀ ਬਹੁਤ ਹੀ ਸ਼ੌਕ ਸੀ ਅਤੇ ਜਦੋਂ ਮੈਂ ਪਹਿਲੀ ਜਮਾਤ ਵਿੱਚ ਸੀ ਉਦੋਂ ਮੈਂ ਬਹੁਤ ਹੀ ਵਧੀਆ ਪੇਂਟਿੰਗ ਕਰਦੀ ਸੀ ਸਭ ਤੋਂ ਪਹਿਲਾਂ ਪਹਿਲੀ ਜਮਾਤ ਵਿੱਚ ਸਾਨੂੰ ਇੱਕ ਝੌਂਪੜੀ ਬਣਾਉਣੀ ਸਿਖਾਈ ਸੀ ਜੋ ਕਿ ਬਹੁਤ ਹੀ ਸੌਖੀ ਸੀ ਅਤੇ ਬਹੁਤ ਹੀ ਜ਼ਿਆਦਾ ਸੋਹਣੀ ਝੌਂਪੜੀ ਮੈਂ ਸ਼ੁਰੂ ਤੋਂ ਹੀ ਬਣਾਉਂਦੀ ਸੀ ਫਿਰ ਉਸ ਤੋਂ ਬਾਅਦ ਸਾਨੂੰ ਪੇਂਟਿੰਗ ਦੇ ਵਿੱਚ ਝੰਡਾ ਬਣਾਉਣਾ ਸਿਖਾਇਆ ਸੀ ਅਤੇ ਝੰਡੇ ਦੇ ਵਿੱਚ ਸਾਨੂੰ ਝੰਡੇ ਦੀ ਅਹਿਮੀਅਤ ਬਾਰੇ ਦੱਸਿਆ ਸੀ ਹੌਲੀ ਹੌਲੀ ਕਰਕੇ ਪੇਂਟਿੰਗ ਵਿੱਚ ਮੇਰਾ ਦਿਲਚਸਪੀ ਬਹੁਤ ਹੀ ਜ਼ਿਆਦਾ ਵਧਣ ਲੱਗੀ ਅਤੇ ਜਿੰਨੇ ਵੀ ਸਕੂਲ ਦੇ ਵਿੱਚ ਪੇਂਟਿੰਗ ਦੇ ਮੁਕਾਬਲੇ ਹੁੰਦੇ ਸਨ ਮੈਂ ਸਭ ਵਿੱਚ ਭਾਗ ਲੈਂਦੀ ਸੀ ਇੱਕ ਵਾਰੀ ਪੇਂਟਿੰਗ ਦੇ ਮੁਕਾਬਲੇ ਵਿੱਚ ਮੈਂ ਭਾਗ ਲੈ ਕੇ ਆਪਣੀ ਮਨਪਸੰਦ ਮੈਡਮ ਦਾ ਚਿਹਰਾ ਆਪਣੇ ਹੱਥਾਂ ਦੇ ਨਾਲ ਤਸਵੀਰ 'ਤੇ ਬਣਾਇਆ ਸੀ ਅਤੇ ਉਸ ਮੈਡਮ ਨੇ ਬਹੁਤ ਹੀ ਜ਼ਿਆਦਾ ਉਸ ਤਸਵੀਰ ਨੂੰ ਪਸੰਦ ਕੀਤਾ ਸੀ ਅਤੇ ਉਸ ਮੈਡਮ ਨੂੰ ਉਸ ਤੋਂ ਬਾਅਦ ਪਤਾ ਲੱਗਿਆ ਕਿ ਮੇਰੇ ਦਿਲ ਵਿੱਚ ਉਸ ਮੈਡਮ ਦੇ ਪ੍ਰਤੀ ਕਿੰਨਾ ਪਿਆਰ ਹੈ ਉਸ ਮੁਕਾਬਲੇ ਦੇ ਵਿੱਚ ਮੈਨੂੰ ਪਹਿਲੇ ਨੰਬਰ 'ਤੇ ਅਵਾਰਡ ਮਿਲਿਆ ਸੀ ਅਤੇ ਸਾਰੇ ਸਕੂਲ ਨੂੰ ਪਤਾ ਲੱਗਿਆ ਸੀ ਕਿ ਮੈਂ ਕਿੰਨੀ ਸੋਹਣੀ ਪੇਂਟਿੰਗ ਕਰਦੀ ਹਾਂ ਉਸ ਤੋਂ ਬਾਅਦ ਉਸ ਮੈਡਮ ਨੇ ਮੈਨੂੰ ਬਹੁਤ ਹੀ ਜ਼ਿਆਦਾ ਪਿਆਰ ਕੀਤਾ ਅਤੇ ਮੈਨੂੰ ਪੁਚਕਾਰਿਆ ਅਤੇ ਉਸ ਤੋਂ ਬਾਅਦ ਮੇਰਾ ਪੇਂਟਿੰਗ ਦੇ ਵਿੱਚ ਹੋਰ ਵੀ ਜ਼ਿਆਦਾ ਦਿਲਚਸਪੀ ਵਧਣ ਲੱਗ ਪਈ ਪੇਂਟਿੰਗ ਤਾਂ ਸਾਨੂੰ ਸਾਰਿਆਂ ਨੂੰ ਹੀ ਸ਼ੁਰੂ ਤੋਂ ਸਭ ਸਕੂਲਾਂ ਵਿੱਚ ਸਿਖਾਈ ਜਾਂਦੀ ਹੈ ਅਤੇ ਮੈਨੂੰ ਵੀ ਸ਼ੁਰੂ ਤੋਂ ਹੀ ਸਿਖਾਈ ਗਈ ਸੀ ਉਸ ਤੋਂ ਬਾਅਦ ਮੈਂ ਹੋਰ ਵੀ ਕਈ ਜਣਿਆਂ ਦੇ ਚਿਹਰਿਆਂ ਨੂੰ ਆਪਣੇ ਹੱਥਾਂ ਦੇ ਨਾਲ ਤਸਵੀਰਾਂ ਬਣਾਈਆਂ ਸੀ ਅਤੇ ਉਹਨਾਂ ਨੂੰ ਉਸ ਤਸਵੀਰਾਂ ਵੀ ਬਹੁਤ ਪਸੰਦ ਆਈਆਂ ਸੀ ਧੰਨਵਾਦ ਜੀ